ਹਾਂਜੀ ਰੋਜੀ ਰੋਟੀ ਬਿਜਲੀ 'ਤੇ ਹੀ ਨਿਰਭਰ ਕਰਦੀ ਹੈ ਕਿਉਂਕਿ ਅੱਜ ਕੱਲ੍ਹ ਸਾਰਾ ਕੁਛ ਹੀ ਇਲੈਕਟ੍ਰੋਨਿਕ ਤਰੀਕੇ ਨਾਲ ਚੱਲ ਰਿਹਾ ਹੈ ਪਹਿਲਾਂ ਆਪਾਂ ਘਰ ਦੀ ਹੀ ਗੱਲ ਕਰ ਲਈਏ ਕੁਛ ਸਬਜ਼ੀ ਬਣਾਉਣੀ ਕੁਛ ਪਿਆਜ਼ ਲਸਣ ਬਲੈਂਡ ਕਰਨਾ ਉਹਨਾਂ ਨੂੰ ਵੀ ਬਿਜਲੀ ਦੀ ਹੀ ਲੋੜ ਪੈਂਦੀ ਹੈ ਪਹਿਲਾਂ ਕੁੰਡੀ ਘੋਟਣੇ ਨਾਲ ਕਰਦੇ ਸੀ ਪਰ ਹੁਣ ਬਿਜਲੀ ਨਾਲ ਹੀ ਹੁੰਦਾ ਹੁ ਇੰਡਕਸ਼ਨ ਚੁੱਲ੍ਹੇ ਦੀ ਗੱਲ ਕਰ ਲਈਏ ਬਿਜਲੀ ਨਾਲ ਹੀ ਚੱਲਦਾ ਏ ਆ ਜੇ ਲਾਈਟ ਹੈ ਨਹੀਂ ਤਾਂ ਆਪਾਂ ਕਿਵੇਂ ਉਹ 'ਤੇ ਕੰਮ ਕਰ ਸਕਦੇ ਰੋਟੀ ਪਾਣੀ ਬਣਾ ਸਕਦੇ ਹਾਂ ਬਾਕੀ ਦੂਜਾ ਕਰੀਏ ਵੀ ਜੇ ਬਾਹਰਲੇ ਸ ਹਿਸਾਬ ਨਾਲ ਕੰਮ ਕਰਦੇ ਹਾਂ ਅਤੇ ਬਾਹਰ ਅੱਜ ਕੱਲ੍ਹ ਸਾਰਾ ਕੁਛ ਇਲੈਕਟ੍ਰੀਕਲ ਚੱਲਦਾ ਆ ਕੰਪਿਊਟਰ ਹੋ ਗਿਆ ਕੋਈ ਆਪਣੀ ਕੋਈ ਫਾਈਲ ਤਿਆਰ ਕਰਨੀ ਕੁਛ ਵੀ ਕਰਨਾ ਸਭ ਕੁਛ ਕੰਪਿਊਟਰਾਂ 'ਤੇ ਹੋ ਗਿਆ ਅੱਜ ਕੱਲ੍ਹ ਆਪਣਾ ਲਿਖਣ ਪੜ੍ਹਨ ਵਾਲਾ ਕੰਮ ਘੱਟ ਗਿਆ ਅਤੇ ਕੰਪਿਊਟਰ ਅਤੇ ਟੈਕਨੋਲਜੀ ਦੇ ਹਿਸਾਬ ਨਾਲ ਆਪਾਂ ਕੰਮ ਤੇਜ਼ੀ ਨਾਲ ਕਰਦੇ ਹਾਂ ਪਰ ਜੇ ਲਾਈਟ ਹੀ ਨਾ ਹੋਵੇ ਤੁਸੀਂ ਲਾ ਲਉ ਵੀ ਆਪ ਹੀ ਸਾਰਾ ਕੁਛ ਤਾਂ ਰੁਕ ਗਿਆ ਅਤੇ ਜੇ ਸ਼ਾਮ ਦੇ ਟਾਈਮ ਲਾਈਟ ਨਹੀਂ ਹੁੰਦੀ ਹੈਗੀ ਤਾਂ ਤੁਸੀਂ ਲਾ ਲਉ ਵੀ ਆਪਾਂ ਰੋਟੀ ਪਾਣੀ ਹੋ ਇਹ ਸਾਰੇ ਕੰਮਾਂ ਤੋਂ ਰੁਕ ਜਾਵਾਂਗੇ ਹਾਂ ਟਾਈਮ ਦੀ ਵੀ ਬੱਚਤ ਹੁੰਦੀ ਆ ਜੇ ਲਾਈਟ ਹੈਗੀ ਆ ਜੇ ਉਹੀ ਆਪਾਂ ਕੁੰਡੀ ਘੋਟਣੇ 'ਚ ਲਸਣ ਪਿਆਜ਼ ਕੱਟਣਾ ਤਾਂ ਕਿੰਨਾਂ ਟਾਈਮ ਲੱਗਦਾ ਆ ਜੇ ਆਪਾਂ ਬਲੈਂਡਰ ਨਾਲ ਕਰਦੇ ਹਾਂ ਉਹ ਕੁਛ ਜਲਦੀ ਹੀ ਸਕਿੰਟਾਂ ਵਿੱਚ ਆਪਾਂ ਨੂੰ ਕੰਮ ਕਰਕੇ ਦੇ ਦਿੰਦਾ ਜੇ ਹੁਣ ਆਪਾਂ ਗੈਸ ਚੁੱਲ੍ਹੇ 'ਤੇ ਕੰਮ ਕਰਦੇ ਹਾਂ ਜਾਂ ਚੁੱਲ੍ਹੇ 'ਤੇ ਕੰਮ ਕਰਦੇ ਹਾਂ ਉਹ 'ਤੇ ਆਪਾਂ ਨੂੰ ਰੋਟੀ ਪਾਣੀ 'ਤੇ ਟਾਈਮ ਲੱਗਦਾ ਇੰਡਕਸ਼ਨ ਦੀ ਸਪੀਡ ਤੇਜ਼ ਆ ਇੰਡਕਸ਼ਨ 'ਤੇ ਆਪਾਂ ਮਿੰਟਾਂ ਸਕਿੰਟਾਂ 'ਚ ਕੰਮ ਕਰਕੇ ਵਿਹਲੇ ਹੋ ਜਾਂਦੇ ਹਾਂ ਇਸ ਕਰਕੇ ਮਤਲਬ ਕਿ ਲਾਈਟ ਦੀ ਬਹੁਤ ਜ਼ਿਆਦਾ ਲੋੜ ਹੈ ਬਿਜਲੀ ਦੇ ਕੱਟਾਂ ਵਿੱਚ ਰੋਸ਼ਨੀ ਦੇ ਪ੍ਰੋਬਲਮ ਤਾਂ ਹੈਗੀ ਹੈ ਕੱਟ ਲੱਗਦੇ ਨੇ ਬਹੁਤ ਲੱਗਦੇ ਨੇ ਪਰ ਕੁਛ ਲੋਕ ਹੈਗੇ ਨੇ ਕਿਹੜੇ ਮੱਧ ਵਰਗੀ ਹੈ ਤਾਂ ਅਮੀਰ ਲੋਕ ਉਹਨਾਂ ਕੋਲ ਤਾਂ ਇੰਨਵਾਈਟਰ ਹੈਗੇ ਨੇ ਆਪਣਾ ਸਾਰੀ ਜਾਂਦੇ ਨੇ ਪਰ ਬਹੁਤ ਗਰੀਬ ਲੋਕ ਨੇ ਝੁੱਗੀ ਝੋਂਪੜੀ ਵਾਲੇ ਕਹਿ ਦਉ ਜਾਂ ਜਿਹੜੇ ਡੇਲੀ ਦੀ ਡੇਲੀ ਕਮਾ ਕੇ ਆਪਣਾ ਇਨਕਮ ਕਰ ਰਹੇ ਆ ਖਾ ਰਹੇ ਆ ਉਹਨਾਂ ਕੋਲ ਤਾਂ ਇਨਵੇਟਰ ਦੀ ਸਹੂਲਤ ਹੀ ਹੈ ਨਹੀਂ ਵਿਚਾਰੇ ਸੜਕਾਂ 'ਤੇ ਸੌਂਦੇ ਨੇ ਸੜਕਾਂ 'ਤੇ ਸੌਂਦੇ ਨੇ ਬੇ ਬ ਬੇਘਰ ਨੇ ਵਿਚਾਰੇ ਗਰਮੀਆਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਤੰਗੀ ਆਉਂਦੀ ਆ ਕਿਉਂਕਿ ਪੱਖਾ ਹੈ ਨਹੀਂ ਮੱਛਰ ਖਾਂਦੇ ਨੇ ਪਰ ਜੇ ਆਪਾਂ ਗੱਲ ਕਰੀਏ ਸਰਦੀਆਂ ਦੀ ਸਰਦੀਆਂ ਵਿੱਚ ਉਹ ਠੰਡ ਨਾਲ ਹੁੰਦੇ ਨੇ ਜੇ ਹੁਣ ਉਹੀ ਉਹਨਾਂ ਕੋਲ ਇਨਵੈਟਰ ਹੋਵੇ ਜਾਂ ਲਾਈਟ ਦਾ ਕੋਈ ਸਾਧਨ ਹੋਵੇ ਆਪਣਾ ਸਰਦੀਆਂ ਨੂੰ ਹੀਟਰ ਲਾ ਕੇ ਰਹਿ ਸਕਦੇ ਹਨ ਗਰਮੀਆਂ ਨੂੰ ਆਪਣਾ ਪੱਖਾ ਜਾਂ ਕੁਛ ਵੀ ਕੂਲਰ ਲਾ ਕੇ ਆਰਾਮ ਕਰ ਸਕਦੇ ਹਨ ਇਸ ਕਰਕੇ ਮਤਲਬ ਕਿ ਲਾਈਟ ਦੀ ਹੋਣੀ ਬਹੁਤ ਜ਼ਰੂਰੀ ਹੈ ਹਨੇਰੇ ਵਿੱਚ ਕੰਮ ਕਰਨਾ ਆਸਾਨ ਨਹੀਂ ਹੈ ਪਹਿਲਾਂ ਲੋਕ ਕਰ ਲੈਂਦੇ ਸੀ ਹੁਣ ਅੱਜ ਕੱਲ੍ਹ ਦੇ ਲੋਕ ਇੰਨੇ ਕੁ ਆਦੀ ਹੋ ਗਏ ਨੇ ਵੀ ਲਾਈਟ ਤੋਂ ਬਿਨਾਂ ਜੀਵਨ ਸੰਭ ਜੀਵਨ ਸੰਭਵ ਲੱਗਦਾ ਹੀ ਨਹੀਂ ਹੈਗਾ ਸਭ ਕੁਛ ਖਤਮ ਜਿਹਾ ਲੱਗਦਾ ਹੈ